ਮਨਦੀਪ ਹਰਵਿੰਦਰ ਤਨਵੀਰ ਅੰਗਦ ਜੋਤ ਗੁਰਦਿਆਲ ਸਿੰਘ ਗੁਰਦੀਪ ਕੌਰ ਸਵਲੀਨ ਅਮਨਪਾਲ ਸਿੰਘ ਇੰਦਰਪਾਲ ਸਿੰਘ ਸੁਰਿੰਦਰ ਸਿੰਘ ਹਰਜੀਤ ਕੌਰ ਮਨਪ੍ਰੀਤ ਸਿੰਘ